ਮੈਂ ਨਾ ਕੁਛ ਜ਼ਿਆਦਾ ਕਿਤੇ ਇਸ ਤਰ੍ਹਾਂ ਬਾਹਰ ਕਿਤੇ ਘੱਟ ਹੀ ਗਿਆ ਹੈ ਨਾ ਯਾਤਰਾ ਦੇ ਉੱਪਰ ਅਤੇ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਮੈਨੂੰ ਜਾਣਾ ਪਿਆ ਸੀਗਾ ਗੁਹਾਟੀ ਆਸਾਮ ਕੌਨਫਰੰਸ ਦੇ ਰਿਲੇਟਿਡ ਅਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਾਪਾ ਵੀ ਗੁਹਾਟੀ ਜਾਣਾ ਵੀ ਮੈਂ ਇਕੱਲਾ ਕਦੇ ਦੂਰ ਗਿਆ ਨਹੀਂ ਇੰਨੀ ਦੂਰ ਕਿਵੇਂ ਕਰੀਏ ਤਾਂ ਮੇਰਾ ਇੱਕ ਨਾ ਸਟੂਡੈਂਟ ਆ ਮੈਂ ਉਹਨੂੰ ਪੜ੍ਹਾਇਆ ਮੁੰਡੇ ਨੂੰ ਦਸਵੀਂ 'ਚ ਅਤੇ ਉਹ ਕਾਫੀ ਜਾਨੀ ਕਿ ਜਿਸ ਤਰ੍ਹਾਂ ਬਾਹਰ ਅੰਦਰ ਜਾਂਦਾ ਰਹਿੰਦਾ ਕਿਉਂਕਿ ਉਹ ਬਿਜ਼ਨਸ ਕਰਦਾ ਅਤੇ ਮੇਰੇ ਦਿਮਾਗ 'ਚ ਆਇਆ ਕਿ ਮੈਂ ਉਹਨੂੰ ਨਾਲ ਲੈ ਜਾਂ ਫਿਰ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਸੀ ਕਿ ਚਿੰਤਾ ਸੁਰੱਖਿਆ ਦੀ ਤਾਂ ਹੈ ਨਾ ਕਿ ਮੈਂ ਫਿਰ ਉਹਨੂੰ ਨਾਲ ਲੈ ਗਿਆ ਸੀ ਦੋ ਜਾਣੇ ਗਏ ਸੀ ਫਿਰ ਗਏ ਤਾਂ ਅਸੀਂ ਇੱਥੋਂ ਪਹਿਲਾਂ ਦਿੱਲੀ ਦਿੱਲੀ ਤੋਂ ਬਾਅਦ ਟਰੇਨ ਸੀ ਸਾਡੀ ਗੁਹਾਟੀ ਦੀ ਉੱਥੋਂ ਟਰੇਨ ਲਈ ਦਿੱਲੀ ਤੋਂ ਅਤੇ ਗੁਹਾਟੀ ਪਹੁੰਚੇ ਉੱਥੇ ਕੌਨਫਰੰਸ ਅਟੈਂਡ ਕੀਤੀ ਤਿੰਨ ਦਿਨ ਅਤੇ ਕੁਦਰਤੀ ਉੱਥੇ ਮੇਰੇ ਦੋ ਹੋਰ ਦੋਸਤ ਪਹੁੰਚੇ ਹੋਏ ਸੀ ਅਸੀਂ ਜਾਣੀ ਚਾਰ ਜਾਣੇ ਗੁਹਾਟੀ ਇਕੱਠੇ ਹੋ ਗਏ ਫਿਰ ਥੋੜ੍ਹਾ ਜਿਹਾ ਸੁਰੱਖਿਅਤ ਮਹਿਸੂਸ ਕੀਤਾ ਅਸੀਂ ਉੱਥੇ ਘੁੰਮੇ ਫਿਰੇ ਗੁਹਾਟੀ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਆਸਾਮ ਦੇ ਵਿੱਚ ਕਾਫੀ ਹਾਲਾਤ ਖਰਾਬ ਨੇ ਉੱਥੇ ਨਕਸਲਵਾਦ ਹੈ ਜਿਸ ਕਰਕੇ ਉੱਥੇ ਝੜਪਾਂ ਹੁੰਦੀਆਂ ਰਹਿੰਦੀਆਂ ਨੇ ਆਰਮੀ ਦੇ ਨਾਲ ਅਤੇ ਇਸ ਕਰਕੇ ਥੋੜ੍ਹਾ ਡਰ ਵੀ ਸੀਗਾ ਚਿੰਤਾ ਵੀ ਸੀ ਪਰ ਫਿਰ ਵੀ ਸਾਡਾ ਉੱਥੇ ਜਿਹੜਾ ਸੀ ਜਾਣਾ ਵਧੀਆ ਰਿਹਾ ਕੌਨਫਰੰਸ ਵਧੀਆ ਸੀ ਆਈਆਈਟੀ ਗੁਹਾਟੀ ਵਧੀਆ ਇੰਸਟੀਚਿਊਟ ਹੈ ਅਤੇ ਜਦੋਂ ਅਸੀਂ ਮੁੜ ਕੇ ਆਏ ਬੜੇ ਜਾਣੀ ਖੁਸ਼ ਸੀਗੇ ਅਸੀਂ ਕਿਉਂਕਿ ਬਹੁਤ ਵਧੀਆ ਜਗ੍ਹਾ ਸੀ ਉੱਥੇ ਸਾਨੂੰ ਬਹੁਤ ਵਧੀਆ ਲੱਗਿਆ ਜਾ ਕੇ